ਵੀਡੀਓ ਕੋਂਨਫਰੈਸਿੰਗ ਸਾਡੇ ਲਈ ਹੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਇਹਨੇ ਬਹੁਤ ਹੀ ਬਦਲਾਵ ਲਾਇਆ ਅਤੇ ਜਿੱਦਾਂ ਅਸੀਂ ਹੁਣ ਕਿਤੇ ਵੀ ਮੀਟਿੰਗ 'ਚ ਜਿੱਦਾਂ ਸਾਨੂੰ ਕੋਈ ਮੀਟਿੰਗ ਅਟੈਂਡ ਕਰਨੀ ਹੁੰਦੀ ਹੈ ਤਾਂ ਵੀਡੀਓ ਕੋਂਨਫਰੈਸਿੰਗ ਦੇ ਜ਼ਰੀਏ ਹੀ ਕਰ ਲੈਂਦੇ ਹੈ ਹੁਣ ਅਸੀਂ ਘਰ ਬੈਠੇ ਹੀ ਇਹਦਾ ਲਾਭ ਚੁੱਕ ਸਕਦੇ ਹਨ ਜਿੱਦਾਂ ਹੁਣ ਇਸ ਮੀਟਿੰਗ ਦਾ ਬਹੁਤ ਹੀ ਵਧੀਆ ਲਾਭ ਹੈ ਜਿੱਦਾਂ ਹੁਣ ਵੀਡੀਓ ਕੋਂਨਫਰੈਸਿੰਗ ਮ ਹੁਣ ਅਸੀਂ ਘਰ ਬੈਠੇ ਵੀ ਕਰ ਸਕਦੇ ਹਾਂ ਜਿੱਦਾਂ ਹੁਣ ਅਸੀਂ ਘੁੰਮਣ ਗਏ ਹੈ ਜਾਂ ਕਿਤੇ ਵੀ ਹੁਣ ਅਸੀਂ ਮਤਲਬ ਫੋਨ ਦੇ ਜ਼ਰੀਏ ਵੀਡੀਓ ਕੋਂਨਫਰੈਸਿੰਗ ਦੇ ਜ਼ਰੀਏ ਹੀ ਇਹਦਾ ਲਾਭ ਉਠਾ ਸਕਦੇ ਹਨ ਜਿਵੇਂ ਕਿ ਇਹਦਾ ਮੈਨੂੰ ਇਹ ਪਸੰਦ ਵੀ ਹੈ ਅਤੇ ਨਾ ਪਸੰਦ ਵੀ ਜਿਵੇਂ ਪਸੰਦ ਦੀ ਗੱਲ ਕਰੀਏ ਤਾਂ ਪਸੰਦ ਇਹ ਹੈ ਕਿ ਹੁਣ ਅਸੀਂ ਘਰ ਬੈਠੇ ਹੀ ਇਹਦਾ ਲਾਭ ਉਠਾ ਸਕਦੇ ਹੈ ਅਤੇ ਸਾਨੂੰ ਪੈਸੇ ਜ਼ਿਆਦਾ ਵੇਸਟ ਕਰਨ ਦੀ ਉਹ ਨਹੀਂ ਜਿੱਦਾਂ ਹੁਣ ਅਸੀਂ ਵੇ ਮੀਟਿੰਗ ਅਟੈਂਡ ਕਰਨੀ ਸੀ ਉੱਥੇ ਜਾਣਾ ਤਾ ਟਰੈਵਲਿੰਗ ਦਾ ਖਰਚਾ ਕਾਫੀ ਵੱਧ ਜਾਣਾ ਤਾ ਹੁਣ ਵੀਡੀਓ ਕੋਂਨਫਰੈਸਿੰਗ ਦੇ ਜ਼ਰੀਏ ਸਾਡਾ ਖਰਚਾ ਘੱਟ ਗਿਆ ਏ ਅਤੇ ਇਹਦਾ ਮਤਲਬ ਘਰ ਬੈਠੇ ਇਹਦਾ ਵਰਤੋਂ ਅਸੀਂ ਕਰ ਸਕਦੇ ਹੈ ਅਤੇ ਨਾ ਪਸੰਦ ਦੀ ਗੱਲ ਕਰੀਏ ਤਾਂ ਜਿੱਦਾਂ ਹੁਣ ਅਸੀਂ ਵੀਡੀਓ ਕੋਂਨਫਰੈਸਿੰਗ ਦੇ ਜ਼ਰੀਏ ਮੀਟਿੰਗ ਅਟੈਂਡ ਕਰ ਰਹੇ ਹੈ ਅਤੇ ਮਤਲਬ ਨੈੱਟ ਕਰਕੇ ਉਹ ਕਈ ਵਾਰੀ ਕੱਟ ਜਾਂਦਾ ਏ ਅਤੇ ਇਹਦਾ ਲਾਭ ਨਹੀਂ ਅਸੀਂ ਉਠਾ ਸਕਦੇ ਇਹਦਾ ਬਹੁਤ ਹੀ ਔਖਾ ਕੰਮ ਹੋ ਜਾਂਦਾ ਏ ਅਤੇ ਜਦ ਇੱਕ ਵਾਰੀ ਕੱਟ ਜਾਂਦਾ ਏ ਫਿਰ ਉਹਨੂੰ ਦੁਬਾਰਾ ਕਰਨ 'ਚ ਬਹੁਤ ਹੀ ਜ਼ਿਆਦਾ ਸਮਾਂ ਲੱਗ ਜਾਂਦਾ ਏ ਅਤੇ ਵੀਡੀਓ ਕੋਂਨਫਰੈਸਿੰਗ ਵੈਸੇ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਅੱਜ ਦੇ ਟਾਈਮ ਵਿੱਚ ਹੋ ਗਿਆ ਏ